ਹੈਲੋ ਹੈਲੋ ਸਰ ਮੈਂ ਤੁਹਾਡੇ ਹੋਟੇਲ ਤੋਂ ਬੋਲ ਰਹੀ ਹਾਂ ਸਰ ਇੱਥੇ ਸਰ ਵਾਈਫਾਈ ਦਾ ਨੈਟਵਰਕ ਨਹੀ ਪ੍ਰੋਪਰ ਵੈਸੇ ਆ ਰਹਾਂ ਵਾਈਫਾਈ ਕਨੈਕਟ ਮੇਰਾ ਨਹੀਂ ਹੋ ਰਹਾ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਰੂਮ ਨੰਬਰ ਏਟ ਫੋਰ ਸੈਵਨ ਨਾਲ ਗੱਲ ਕਰ ਰਹੀ ਆ ਤੇ ਸਰ ਮੈਨੂੰ ਸਰ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਹ ਮੈਂ ਜਦੋਂ ਦੀ ਐਂਟਰ ਹੋਈ ਆ ਆਪਣੇ ਰੂਮ ਦੇ ਵਿੱਚ ਮੈਂ ਆਪਣੇ ਫੈਮਲੀ ਮੈਂਬਰ ਨੂੰ ਇਨਫੋਰਮ ਕਰਨਾ ਸੀਗਾ ਬਟ ਮੈਂ ਉਹਨਾਂ ਨੂੰ ਕਰ ਹੀ ਨਹੀਂ ਪਾ ਰਹੀ ਆ ਕਿਉਂਕਿ ਵਾਈਫਾਈ ਕਨੈਕਸ਼ਨ ਇਹਦੇ ਵਿੱਚ ਪ੍ਰੋਪਰ ਵੈਸੇ ਅਵੇਲੇਬਲ ਹੈ ਹੀ ਨਹੀਂ ਹੈ ਮੇਰੀ ਕਾਲ ਬਾਰ ਬਾਰ ਡਿਸਕਨੈਕਟ ਹੋਈ ਜਾਂਦੀ ਹੈ ਮੈਂ ਕਿੰਨੀ ਵਾਰੀ ਫੋਨ ਕਾਲਿੰਗ ਵੀ ਦਾ ਮਤਲਬ ਕੀਤੀ ਹੋਈ ਹੈ ਬਟ ਇਥੇ ਸਰਵਿਸਿੰਗ ਪ੍ਰੋਪਰ ਵੈਸੇ ਹੈ ਹੀ ਨਹੀਂ ਹੈਗੀ ਸਰ ਪਾਸਵਰਡ ਪਾਸਪੋਰਟ ਜਿਹੜਾ ਤੁਸੀਂ ਇਥੇ ਮੈਨਸ਼ਨ ਕੀਤਾ ਹੋਇਆ ਹੋਟੇਲ ਦੇ ਵਿੱਚ ਨੰਬਰ ਮੈਂ ਤਾਂ ਉਹੀ ਯੂਜ ਕਰਦੀ ਪਈ ਆ ਬਟ ਮੈਨੂੰ ਕਾਫੀ ਟਾਈਮ ਹੋ ਗਿਆ ਐਮ ਰੇਅਲੀ ਵੈਰੀ ਸੋਰੀ ਬਟ ਆਪ ਕਨੈਕਸ਼ਨ ਪ੍ਰੋਪਰ ਵੈਸੇ ਆ ਨੀ ਰਿਹਾ ਹਾਂਜੀ ਸਰ ਮੈਂ ਦੱਸਦੀ ਆਂ ਟੂ ਫਾਈਵ ਸਿਕਸ ਸੈਵਨ ਹਾਂ ਦੋ ਪੰਜ ਛੇ ਸੱਤ

ਓਕੇ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਮੈਂ ਟਰਾਈ ਕਰਦੀ ਆ ਬਟ ਇੱਧਰ ਵੈਸੇ ਠੀਕ ਹੈ ਸਰ ਮੈਂ ਕਰਦੀ ਪਰ ਮੈਂ ਤੁਹਾਨੂੰ ਪੁੱਛਣਾ ਸਰ ਮੈਂ ਇਹ ਪੁੱਛਣਾ ਨਹੀਂ ਸਰ ਮੇਰੇ ਕੋਲ ਦੂਜਾ ਫੋਨ ਨਹੀਂ ਹੈਗਾ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਇੱਥੇ ਪ੍ਰੋਪਰ ਵੈਸੇ ਕਨੈਕਸ਼ਨ ਕਿਹੜੇ ਆਉਂਦਾ ਮਤਲਵ ਆਈਡੀਆ ਦਾ ਆਉਂਦਾ ਕੀ ਨੋਕੀਆ ਦਾ ਜਾਂ ਜੀਓ ਦਾ

ਸਰ ਮੈਨੂੰ ਨਹੀਂ ਸਰ ਫੈਸਲਿਟੀਜ ਨੂੰ ਦੇਖ ਕੇ ਤੇ ਅਸੀਂ ਆਹ ਹੋਟਲ ਤੁਹਾਡਾ ਅਸੀਂ ਰਿਕਮੈਂਡ ਕੀਤਾ ਸੀਗਾ ਤੇ ਅਸੀਂ ਆਏ ਹਾਂ ਬਟ ਸਰ ਮੇਰਾ ਰੂਮ ਨੰਬਰ ਹੈਗਾ ਅੱਠ ਚਾਰ ਸੱਤ

ਸਰ ਮੇਰਾ ਨਾਂ ਸਿਮਰਨਜੀਤ ਕੌਰ ਹ ਤੇ ਮੈਂ ਮੁੰਬਈ ਤੋਂ ਆਈ ਮੈਂ ਮੁੰਬਈ ਤੋਂ ਆਈ ਆ ਜੀ ਸਰ ਸਰ ਮੈਂ ਸਰ ਬਹੁਤ ਬਹੁਤ ਤੇਜ਼ ਕਰਦੀ ਪਈ ਆ ਕਿਉਂਕਿ ਮੈਂ ਹਾਲੇ ਤੱਕ ਮੈਂ ਆਪਣੇ ਪੇਰੈਂਟਸ ਨੂੰ ਨਹੀਂ ਦੱਸ ਸਕੀ ਏ ਕਿ ਮੈਂ ਪ੍ਰੋਪਰ ਵੈਸੇ ਹੋਟਲ ਪਹੁੰਚ ਗਈ ਆ ਕਿ ਨਹੀਂ ਹੁਣ ਨੈਟਵਰਕ ਤਾਂ ਇੰਨੀ ਪ੍ਰੋਬਲਮ ਹੈਗੀ ਆ

ਠੀਕ ਹੈ ਸਰ ਲਿਖਵਾਓ ਸਰ ਹਾਂਜੀ ਸਰ ਜੀ ਸਰ ਐਚ ਐਟ ਦੀ ਰੇਟ ਇਕ ਦੋ ਤਿਨ ਚਾਰ ਪੰਜ ਛੇ ਸੱਤ ਅੱਠ ਸਰ ਮੈਂ ਟਰਾਈ ਕਰਦੀ ਆਂ ਤੁਸੀਂ ਹੋਲਡ ਤੇ ਰਹਿਓ ਮੈਂ ਤੁਹਾਨੂੰ ਹੁਣੇ ਅਪਡੇਟ ਕਰਦੀ ਤੁਸੀਂ ਪਲੀਜ਼ ਕਾਲ ਤੇ ਰਹਿਓ ਕਿਉਂਕਿ ਮੈਂ ਬਹੁਤ ਪਹਿਲਾਂ ਵੀ ਟਰਾਈ ਕੀਤਾ ਸੀਗਾ ਹਾਂ

ਸਰ ਨਹੀਂ ਹੋ ਰਿਹਾ ਮੈਂ ਹੁਣੇ ਟਰਾਈ ਕੀਤਾ ਬਟ ਹੋ ਨਹੀਂ ਰਿਹਾ ਪਾਸਵਰਡ ਸਰ ਇੱਕ ਵਾਰ ਦੁਬਾਰਾ ਤੁਸੀਂ ਸੁਣਿਓ ਪਲੀਜ਼ ਐਚ ਐਟ ਦੀ ਰੇਟ ਇਕ ਦੋ ਤਿੰਨ ਚਾਰ ਪੰਜ ਛੇ ਸੱਤ ਤੇ ਅੱਠ ਓਕੇ ਨੋ ਹਾਂਜੀ ਫਿਰ ਹੁਣ ਹੋਇਆ ਹਾਂਜੀ ਸਰ ਹੁਣ ਹੋਇਆ ਹਾਂਜੀ ਹਾਂਜੀ ਹਾਂਜੀ ਹੁਣ ਹੋਇਆ ਨੀ ਸਰ ਕੋਈ ਗੱਲ ਨਹੀਂ ਬਟ ਤੁਹਾਡਾ ਜਿਹੜਾ ਰੇਟਿੰਗ ਸੀਗਾ ਬਹੁਤ ਵਧੀਆ ਸੀਗਾ ਅਸੀਂ ਆਨਲਾਈਨ ਚੈੱਕ ਕੀਤਾ ਸੀਗਾ ਜਦੋਂ ਅਸੀਂ ਹੋਟਲ ਬੁਕਿੰਗ ਕਰਨੀ ਸੀਗੀ ਤੇ ਤੁਹਾਡੇ ਰੇਟਿੰਗ ਦੇ ਵਜਹਾ ਦੇ ਨਾਲ ਹੀ ਅਸੀਂ ਇੱਥੇ ਆਏ ਆਂ ਬਟ ਮੈਂ ਬਹੁਤ ਸਫਰ ਕੀਤਾ ਬਟ ਚਲੋ ਸਾਡਾ ਸੋਲਵ ਹੋ ਗਿਆ ਐਕਚੁਲੀ ਸਰ ਮੈਂ ਟਰਾਈ ਕਰਦੀ ਪਈ ਸੀਗੀ ਬਟ ਤੁਹਾਡਾ ਨੰਬਰ ਹੀ ਨਹੀਂ ਪ੍ਰੋਪਰ ਵੇਸੇ ਲੱਗਦਾ ਪਿਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਨੈਟਵਰਕ ਦੀ ਪ੍ਰੋਬਲਮ ਸੀਗੀ ਬਟ ਹੁਣ ਜਸਟ ਤੁਸੀਂ ਆਹ ਸੋਲਵ ਕੀਤਾ ਥੈਂਕਯੂ ਸੋ ਮਚ ਤੇ ਹਾਂ ਥੈਂਕਯੂ ਸੋ ਮੱਚ ਥੈਂਕਯੂ ਸੋ ਮੱਚ ਸਰ ਓਕੇ ਸਰ ਸਤਿ ਸ਼੍ਰੀ ਅਕਾਲ